ਗੌਣ ਦਾ ਪ੍ਰਦਰਸ਼ਨ ਕਰਦੇ ਸਮੇਂ ਸਾਨੂੰ ਆਪਣੇ ਮੁੱਖ ਦੇ ਹਾਵ ਭਾਵ ਨੂੰ ਬਿਲਕੁਲ ਸਹੀ ਰੱਖਣਾ ਚਾਹੀਦਾ ਹੈ ਤਾਂ ਕਿ ਸਾਡੇ ਜੋ ਅਡੀਸ਼ਨ ਵਾਲੇ ਲੋਕ ਹਨ ਉਹਨਾਂ ਨੂੰ ਇੰਝ ਨਾ ਲੱਗੇ ਕਿ ਬੰਦਾ ਹਾਈਪਰ ਹੋ ਰਿਹਾ ਹੈ ਜਾਂ ਫਿਰ ਨਰਵਸ ਹੋ ਰਿਹਾ ਹੈ ਇਸ ਦੇ ਨਾਲ ਸਾਨੂੰ ਆਪਣੇ ਗਲੇ ਦੇ ਲਈ ਸਾਨੂੰ ਆਪਣੀ ਬਿਹਤਰ ਆਵਾਜ਼ ਦੇ ਲਈ ਚੰਗੀਆਂ ਚੀਜ਼ਾਂ ਖਾਣੀਆਂ ਪੈਂਦੀਆਂ ਹਨ ਜਿੱਦਾਂ ਕਿ ਗਰਮ ਪਾਣੀ ਪੀਣਾ ਪੈਂਦਾ ਹੈ ਖੱਟੇ ਮਸਾਲੇਦਾਰ ਭੋਜਨ ਨੂੰ ਅਵੋਇਡ ਕਰਨਾ ਪੈਂਦਾ ਹੈ ਇਸ ਦੇ ਨਾਲ ਸਾਨੂੰ ਹੋਰ ਠੰਡੀਆਂ ਚੀਜ਼ਾਂ ਨੂੰ ਵੀ ਅਵੋਇਡ ਕਰਨਾ ਪੈਂਦਾ ਹੈ ਤਾਂ ਕਿ ਸਾਡੇ ਗਲੇ ਨੂੰ ਤੰਦਰੁਸਤੀ ਨਾਲ ਅੱਗੇ ਵਧਾਇਆ ਜਾ ਸਕੇ ਅਤੇ ਅਸੀਂ ਚੰਗੀ ਤਰੀਕੇ ਨਾਲ ਗਾ ਸਕੀਏ ਇਸ ਦੇ ਨਾਲ ਸਾਨੂੰ ਰਿਆਜ਼ ਕਰਨ ਦੀ ਵੀ ਬਹੁਤ ਜਰੂਰਤ ਪੈਂਦੀ ਹੈ ਜੋ ਕਿ ਅਲੱਗ ਅਲੱਗ ਸਮੇਂ ਦੇ ਹਿਸਾਬ ਨਾਲ ਅਲੱਗ ਅਲੱਗ ਰਿਆਜ਼ ਹੁੰਦੇ ਹਨ ਜਿੱਦਾਂ ਕਿ ਭੈਰਵ ਰਾਗ ਅਲੱਗ ਅਲੱਗ ਰਾਗ ਜੋ ਕਿ ਸਮੇਂ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਵਰਤੇ ਜਾਂਦੇ ਹਨ ਅਤੇ ਹੋਰ ਵੀ ਇਦਾਂ ਦੇ ਰਾਗ ਹਨ ਜਿਨਾਂ ਦੇ ਨਾਲ ਸਾਡੀ ਆਵਾਜ਼ ਗਹਿਰੀ ਤੇ ਕਠੋਰ ਵੀ ਹੁੰਦੀ ਹੈ ਅਤੇ ਕੁਛ ਰਾਗ ਇਦਾਂ ਦੇ ਹਨ ਜਿਨਾਂ ਦੇ ਨਾਲ ਸਾਡੀ ਆਵਾਜ਼ ਸੋਫਟ ਵੀ ਹੁੰਦੀ ਹੈ ਅਤੇ ਇਹਨਾਂ ਰਾਗਾਂ ਦੀ ਵਰਤੋਂ ਬਿਨਾਂ ਕਿਸੀ ਗੁਰੂ ਦੇ ਨਹੀਂ ਕੀਤੀ ਜਾਂਦੀ ਕਿਉਂਕਿ ਗੁਰੂ ਸਾਨੂੰ ਦੱਸਦੇ ਹਨ ਕਿ ਇਹ ਰਾਗ ਕਿਸ ਸਮੇਂ ਕਦੋਂ ਕਿੱਦਾਂ ਬੋਲਣੇ ਚਾਹੀਦੇ ਹਨ ਅਤੇ ਕਿਹਨਾਂ ਵਰਤੋਂ ਕਰਕੇ ਬੋਲਣੇ ਚਾਹੀਦੇ ਹਨ